ਹੈਲੋ ਹਾਂਜੀ ਗੁਡ ਆਫਟਰਨੂਨ ਜੀ ਹਾਂਜੀ ਹਾਂਜੀ ਹਾਂਜੀ ਮੈਡਮ ਕੰਪਿਊਟਰ ਟੀਚਰ ਲਈ ਵਕੈਂਸੀ ਤਾਂ ਹੈਗੀ ਹੈ ਤੁਸੀਂ ਕਿੱਥੋਂ ਬੋਲ ਰਹੇ ਹੋ ਓਕੇ ਜਲੰਧਰ ਤੋਂ ਬੋਲ ਰਹੇ ਹੋ ਕਿੱਥੋਂ ਪੜ੍ਹੇ ਹੋ ਤੁਸੀਂ ਤੁਸੀਂ ਗ੍ਰੈਜੂਏਸ਼ਨ ਆਪਣੀ ਕਿੱਥੋਂ ਕਿਹੜੇ ਕਾਲਜ ਤੋਂ ਓਕੇ ਫਿਲੌਰ ਤੋਂ ਪੜ੍ਹੇ ਹੋ ਠੀਕ ਹੈ ਜੀ ਠੀਕ ਹੈ ਜੀ ਕਿੰਨੇ ਕਿੰਨੇ ਮਾਰਕਸ ਲਏ ਆ ਮੈਡਮ ਤੁਸੀਂ ਠੀਕ ਹੈ ਗਰੈਜੂਏਸ਼ਨ ਵਿੱਚੋਂ ਕਿੰਨੇ ਮਾਰਕਸ ਨੇ ਮੈਡਮ ਤੁਹਾਡੇ ਏਟੀ ਸੈਂਟ ਹੈ ਠੀਕ ਹੈ ਅਤੇ ਕੰਪਿਊਟਰ ਦਾ ਤੁਸੀਂ ਡਿਪਲੋਮਾ ਕੀਤਾ ਹੋਇਆ ਓਕੇ ਠੀਕ ਹੈ ਜੀ ਕਿਹੜਾ ਵਾਲਾ ਕੀਤਾ ਹੋਇਆ ਡਿਪਲੋਮਾ ਤੁਸੀਂ ਕੰਪਿਊਟਰ ਟੀਚਰ ਟਰੇਨਿੰਗ ਕੋਰਸ ਠੀਕ ਹੈ ਮੈਡਮ ਅਤੇ ਹੋਰ ਕਿੱਥੇ ਕਿੱਥੇ ਪਹਿਲਾਂ ਪੜ੍ਹਾ ਚੁੱਕੇ ਹੋ ਤੁਸੀਂ ਕਿਤੇ ਪੜ੍ਹਾਇਆ ਪਹਿਲਾਂ ਜਿਵੇਂ ਕਿ ਸਕੂਲ ਦਾ ਨਾਮ ਦੱਸੋਗੇ ਕਿ ਕਿਹੜੇ ਸਕੂਲ 'ਚ ਪੜ੍ਹਾਇਆ ਤੁਸੀਂ ਅੱਛਾ ਜੇ ਐਸ ਮੋਡਲ ਸਕੂਲ ਇਹ ਕਿੱਥੇ ਹੈਗਾ ਠੀਕ ਹੈ ਜੀ ਜਲੰਧਰ 'ਚ ਹੀ ਹੈ ਓਕੇ ਠੀਕ ਹੈ ਤੁਸੀਂ ਰਹਿਣ ਵਾਲੇ ਵੀ ਜਲੰਧਰ ਦੇ ਹੀ ਹੋ ਠੀਕ ਹੈ ਜੀ ਲੁਧਿਆਣੇ ਤੋਂ ਠੀਕ ਹੈ ਆਉਣਾ ਤੁਸੀਂ ਓਕੇ ਹੋਰ ਕਿਹੜੇ ਸਕੂਲ 'ਚ ਪੜ੍ਹਾਇਆ ਤੁਸੀਂ ਠੀਕ ਹੈ ਅਤੇ ਓਕੇ ਵੈਰੀ ਗੁਡ ਮੈਮ ਬਹੁਤ ਅੱਛਾ ਇਹ ਤਾਂ ਵੀਹ ਸਾਲ ਦਾ ਐਕਸਪੀਰੀਅੰਸ ਆ ਤੁਹਾਨੂੰ ਅਤੇ ਕੋਈ ਗੱਲ ਨਹੀਂ ਅਸੀਂ ਦੇਖਦੇ ਹਾਂ ਜੋਬ ਵਾਸਤੇ ਕਲਾਸਿਸ ਕਿਹੜੀਆ ਕਿਹੜੀਆਂ ਲੈ ਲੈਂਦੇ ਹੋ ਤੁਸੀਂ ਠੀਕ ਹੈ ਏਟਥ ਤੱਕ ਗੁੱਡ ਠੀਕ ਹੈ ਮੈਡਮ ਓਕੇ ਮੈਡਮ ਔਰ ਆਫਿਸ ਦਾ ਵੀ ਥੋੜ੍ਹਾ ਕੰਮ ਕਰ ਲੈਂਦੇ ਹੋ ਠੀਕ ਹੈ ਜੀ ਕੋਈ ਗੱਲ ਨਹੀਂ ਫਿਰ ਤੁਹਾਨੂੰ ਅਸੀਂ ਤੁਸੀਂ ਵਿਜਿਟ ਕਰੋ ਸਾਡੇ ਕੋਲ ਵਿਜਿਟ ਕਰੋ ਫਿਰ ਤੁਹਾਡਾ ਅਸੀਂ ਦੇਖ ਲੈਂਦੇ ਹਾਂ ਠੀਕ ਹੈ ਓਕੇ ਜੀ